ਸਾਡੇ ਇਲਾਕੇ ਦੇ ਲੋਕ ਆਰਟੀਫਿਸ਼ਅਲ ਇੰਟੈਲੀਜੇਂਸ ਨੂੰ ਬਹੁਤ ਜ਼ਿਆਦਾ ਵਰਤ ਰਹੇ ਹਨ ਆਰਟੀਫਿਸ਼ਅਲ ਇੰਟੈਲੀਜਸ ਨੇ ਤਾਂ ਪੜ੍ਹਾਈ ਦੇ ਖੇਤਰ ਵਿੱਚ ਇੱਕ ਇਨਕਲਾਬ ਹੀ ਲੈ ਆਉਂਦਾ ਹੈ ਬੱਚਿਆਂ ਦੀ ਪੜ੍ਹਾਈ ਬਹੁਤ ਜ਼ਿਆਦਾ ਆਸਾਨ ਹੋ ਗਈ ਹੈ ਇਸ ਦੇ ਨਾਲ ਤੁਸੀਂ ਜੋ ਵੀ ਜਾਣਕਾਰੀ ਲੈਣੀ ਹੈ ਮਸ਼ੀਨ ਆਪਣੀ ਇੰਟੈਲੀਜਸ ਦੇ ਨਾਲ ਹੀ ਤੁਹਾਨੂੰ ਵਧੀਆ ਸਲਾਹ ਦੇ ਦਿੰਦੀ ਹੈ ਕਿਸੇ ਬੱਚੇ ਨੇ ਪੜ੍ਹਾਈ ਕਰਨੀ ਹੋਵੇ ਕਿਸੇ ਗ੍ਰਹਿਣੀ ਨੇ ਕੋਈ ਵਧੀਆ ਡਿਸ਼ ਬਣਾਉਣੀ ਹੋਵੇ ਕਿਸੇ ਨੇ ਕੋਈ ਪ੍ਰੋਪਰਟੀ ਖਰੀਦਣੀ ਹੋਵੇ ਜਾਂ ਇਸ ਸਬੰਧੀ ਕੋਈ ਕਾਗਜ਼ ਪੱਤਰ ਭਰਨੇ ਹੋਣ ਤਾਂ ਇਸਦੀ ਜਾਣਕਾਰੀ ਤੁਹਾਨੂੰ ਬੜੇ ਆਰਾਮ ਨਾਲ ਆਰਟੀਫਿਸ਼ਅਲ ਇੰਟੈਲੀਜੇਂਸ ਦੀ ਮਦਦ ਨਾਲ ਘਰ ਬੈਠੇ ਪ੍ਰਾਪਤ ਹੋ ਜਾਂਦੀ ਹੈ ਹੈ ਨਾ ਕਿੰਨੀ ਵਧੀਆ ਗੱਲ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਤਾਂ ਐਕਸਪਰਟ ਵੀ ਵਰਤਦੇ ਹਨ ਉਹ ਆਪਣੇ ਗਿਆਨ ਵਿੱਚ ਵਾਧਾ ਕਰਨ ਦੇ ਲਈ ਇਸ ਦੀ ਵਰਤੋਂ ਕਰਦੇ ਹਨ ਆਰਟੀਫਿਸ਼ਲ ਇੰਟੈਲੀਜੈਂਸ ਨੇ ਸਾਡੀ ਰੋਜ਼ਾਨਾ ਜਿੰਦਗੀ ਨੂੰ ਹਰ ਪਾਸੋਂ ਛੂਹਿਆ ਹੈ ਇਸਦੀ ਮਦਦ ਦੇ ਨਾਲ ਜ਼ਿੰਦਗੀ ਆਸਾਨ ਹੋ ਗਈ ਹੈ ਅਤੇ ਹਰ ਕੰਮ ਕਰਨਾ ਬਹੁਤ ਆਸਾਨ ਹੋ ਗਿਆ ਹੈ